ਹਾਂਜੀ ਸਰਕਾਰ ਸਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਿਸੇ ਵੀ ਖੇਤਰ ਵਿੱਚ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ਜਿਹੜਾ ਕਿ ਨਿੱਜੀ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕਰੇ ਉਹ ਕਾਰੋਬਾਰ ਹਨ ਜਿਹਨਾਂ ਵਿੱਚ ਸਰਕਾਰ ਆਰਥਿਕ ਸਹਾਇਤਾ ਦਿੰਦੀ ਹੈ ਉਹ ਸਹਾਇਤਾ ਵਿੱਚ ਸਭ ਤੋਂ ਪਹਿਲਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਮਸਾਲੇ ਬਣਾਉਣੇ ਅਚਾਰ ਜੈਮ ਅਤੇ ਚਟਣੀਆਂ ਬਣਾਉਣੀਆਂ ਸ਼ਾਮਿਲ ਹਨ ਇਹ ਘਰੇਲੂ ਉਦਯੋਗ ਬਹੁਤ ਹੀ ਸਸਤੇ ਅਤੇ ਵਧੀਆ ਢੰਗ ਨਾਲ ਔਰਤਾਂ ਬਣਾ ਸਕਦੀਆਂ ਹਨ ਸਰਕਾਰ ਇਸ ਨੂੰ ਸ਼ੁਰੂ ਕਰਨ ਵਾਸਤੇ ਆਰਥਿਕ ਸਹਾਇਤਾ ਵੀ ਦਿੰਦੀ ਹੈ ਇਹ ਸਹਾਇਤਾ ਪ੍ਰਾਪਤ ਕਰਨ ਵਾਸਤੇ ਸਾਨੂੰ ਸਰਕਾਰੀ ਅਦਾਰੇ ਜੋ ਕਿ ਇੰਟਰਨੈਟ 'ਤੇ ਉਪਲਬਧ ਹਨ ਆਨਲਾਈਨ ਫਾਰਮ ਭਰ ਕੇ ਪ੍ਰਾਪਤ ਹੋ ਸਕਦੇ ਹਨ ਸਰਕਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਵਿੱਚ ਹਰ ਹੀਲੇ ਮਦਦ ਕਰਦੀ ਹੈ ਇਸ ਲਈ ਤੁਹਾਨੂੰ ਉਸ ਯੋਗਤਾ ਅਨੁਸਾਰ ਇਹ ਫਾਰਮ ਭਰ ਕੇ ਸਰਕਾਰੀ ਦਫਤਰ ਵਿੱਚ ਜਮ੍ਹਾਂ ਕਰਵਾਉਣਾ ਪਏਗਾ ਇਸ ਲਈ ਕੁਝ ਸਧਾਰਨ ਸ਼ਰਤਾਂ ਵੀ ਹੁੰਦੀਆਂ ਹਨ ਜਿਵੇਂ ਕਿ ਘੱਟ ਤੋਂ ਘੱਟ ਉਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਮੈਟਰਿਕ ਦਸਵੀਂ ਕਲਾਸ ਜਾਂ ਬਾਰ੍ਹਵੀਂ ਕਲਾਸ ਵਿੱਚ ਪੜ੍ਹਿਆ ਹੋਇਆ ਹੋਣਾ ਜ਼ਰੂਰੀ ਹੈ ਪੰਜਾਬੀ ਲਾਜ਼ਮੀ ਤੌਰ 'ਤੇ ਬੋਲਣੀ ਅਤੇ ਲਿਖਣੀ ਆਉਣੀ ਚਾਹੀਦੀ ਹੈ ਖੇਤਰੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਹ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਆਰਥਿਕ ਸਹਾਇਤਾ ਦੁਆਰਾ ਦਿੱਤੀ ਗਈ ਰਾਸ਼ੀ ਨੂੰ ਅਸੀਂ ਕੁਝ ਸਮਾਂ ਪਾ ਕੇ ਹੌਲੀ ਹੌਲੀ ਥੋੜ੍ਹੀ ਥੋੜ੍ਹੀ ਕਿਸ਼ਤ ਦੇ ਰੂਪ ਵਿੱਚ ਬਿਨਾਂ ਵਿਆਜ ਤੋਂ ਮੋੜ ਸਕਦੇ ਹਾਂ ਇਸ ਲਈ ਜਾਣਕਾਰੀ ਸਰਕਾਰੀ ਅਦਾਰੇ ਉਹਨਾਂ ਦੀਆਂ ਵੈਬਸਾਈਟਾਂ ਉੱਤੇ ਉਪਲਬਧ ਹਨ ਜੋ ਕਿ ਇੱਕ ਆਮ ਸਧਾਰਨ ਵਿਅਕਤੀ ਆਨਲਾਈਨ ਵੀ ਇਸ ਨੂੰ ਪੜ੍ਹ ਕੇ ਅਪਲਾਈ ਕਰ ਸਕਦਾ ਹੈ ਧੰਨਵਾਦ